ਅੱਜ ਕੱਲ ਦਾ ਸਮਾਂ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਵਿਦਿਆਰਥੀਆਂ ਵਿੱਚ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਹੈ ਜਿਸ ਤਰ੍ਹਾਂ ਸਕੂਲ ਵਿੱਚ ਹੁਣ ਸ਼ਾਮ ਦੀ ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਵੀ ਦੀ ਪ੍ਰਚਲਨ ਕਾਫੀ ਵੱਧ ਗਿਆ ਹੈ ਇਸਦਾ ਕਾਰਨ ਇਹ ਹੈ ਕਿ ਇੱਕ ਤਾਂ ਕੰਪ ਕੰਪੀਟੀਸ਼ਨ ਦਾ ਦੌਰ ਹੈ ਅਤੇ ਅੱਜ ਦੀ ਪੜ੍ਹਾਈ ਵੀ ਕਾਫੀ ਟਫ ਹੋ ਚੁੱਕੀ ਹੈ ਜਿਸ ਕਾਰਨ ਬੱਚਿਆਂ ਨੂੰ ਸ਼ਾਮ ਦੀ ਟਿਊਸ਼ਨ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਦੂਜੇ ਪਾਸੇ ਜੇ ਸੋਚਿਆ ਜਾਵੇ ਤਾਂ ਟਿਊਸ਼ਨ ਲੈਣ ਬਾਰੇ ਮੇਰੇ ਵਿਚਾਰ ਇਹ ਹਨ ਕਿ ਇਸ ਦਾ ਬੁਰਾ ਪ੍ਰਭਾਵ ਵੀ ਕਾਫੀ ਪੈਂਦਾ ਹੈ ਜੋ ਕਿ ਅੱਜ ਕੱਲ ਦੇ ਸਮੇਂ ਵਿੱਚ ਕਾਫੀ ਮਹਿੰਗੀ ਐਜੂਕੇਸ਼ਨ ਹੈ ਅਤੇ ਟਿਊਸ਼ਨ ਫੀਸਾਂ ਵੀ ਕਾਫੀ ਮੋਟੀਆਂ ਮੋਟੀਆਂ ਲਈਆਂ ਜਾਂਦੀਆਂ ਹਨ ਜਿਸ ਕਾਰਨ ਗਰੀਬ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਟਿਊਸ਼ਨ ਨਹੀਂ ਪੜ੍ਹਾ ਸਕਦੇ ਦੂਸਰਾ ਇਹ ਹੈ ਕਿ ਇਹਨਾਂ ਬੱਚਿਆਂ ਉੱਪਰ ਮਾਨਸਿਕ ਪ੍ਰਭਾਵ ਜ਼ਿਆਦਾ ਪੈਂਦਾ ਹੈ ਅਤੇ ਉਹ ਕਾਫੀ ਤਰੀਕੇ ਨਾਲ ਮਾਨਸਿਕ ਤੌਰ 'ਤੇ ਵੀ ਬਿਮਾਰ ਹੋ ਸਕਦੇ ਹਨ ਇਸ ਤਰ੍ਹਾਂ ਮੇਰੇ ਵਿਚਾਰ ਇਹ ਹਨ ਕਿ ਟਿਊਸ਼ਨ ਪੜ੍ਹਨੀ ਵੀ ਜ਼ਰੂਰੀ ਹੈ ਅਤੇ ਨਹੀਂ ਵੀ